ਮੈਂ ਇੱਕ ਓਨਲਾਇਨ ਸੂਟ ਮੰਗਵਾਇਆ ਸੀ ਜਿਸ ਦਾ ਕਲਰ ਓਨਲਾਇਨ ਦੇ ਰੂਪ ਵਿੱਚ ਤਾਂ ਬਹੁਤ ਵਧੀਆ ਦੱਸਿਆ ਹੋਇਆ ਸੀ ਪਰ ਮੈਂ ਜਦੋਂ ਉਹਨੂੰ ਮੰਗਵਾਇਆ ਤਾਂ ਉਹ ਬਿਲਕੁਲ ਹੀ ਡੱਲ ਉਹਦਾ ਕਲਰ ਬਿਲਕੁਲ ਹੀ ਉਹਦੀ ਕੁਆਲਟੀ ਬੇਕਾਰ ਸੀਗੀ ਬਿਲਕੁਲ ਹੀ ਅੱਛਾ ਨਹੀਂ ਸੀ ਓਨਲਾਇਨ ਵਿੱਚ ਹੀ ਉਹ ਚੰਗਾ ਲੱਗ ਰਿਹਾ ਸੀ ਪਰ ਰੀਅਲ ਵਿੱਚ ਉਹ ਬਿਲਕੁਲ ਬੇਕਾਰ ਸੀ ਜਿਵੇਂ ਕਿ ਮੈਂ ਹੈਡਫ਼ੋਨ ਵੀ ਮੀਸ਼ੋ ਐਪ ਤੋਂ ਮੰਗਵਾਏ ਸੀਗੇ ਉਹਦੀ ਵੀ ਕੁਆਲਟੀ ਅੱਛੀ ਦੱਸ ਰਹੇ ਸੀ ਪਰ ਜਦੋਂ ਮਿਲੇ ਤਾਂ ਉਹਦੀ ਬਿਲਕੁਲ ਹੀ ਡੱਲ ਸੀ ਉਹਦੀ ਤਾਰ ਨਿਕਲੀ ਹੋਈ ਸੀ ਉਹ ਮੇਰੇ ਲਈ ਬਿਲਕੁਲ ਬੇਕਾਰ ਸੀ ਇਸ ਕਰਕੇ ਓਨਲਾਇਨ ਚੀਜ਼ ਨਹੀਂ ਮੰਗਵਾਉਣੀ ਚਾਹੀਦੀ ਮੈਨੂੰ ਤਾਂ ਦੋ ਚੀਜ਼ਾਂ ਓਨਲਾਇਨ ਮੰਗਵਾਈਆਂ ਮੈਨੂੰ ਬਿਲਕੁਲ ਬੇਕਾਰ ਮਿਲੀਆਂ ਜਿਵੇਂ ਕਿ ਸੂਟ ਸੀਗਾ ਬਿਲਕੁਲ ਉਹਦਾ ਕਲਰ ਡੱਲ ਮਿਲਿਆ ਮੈਨੂੰ ਅਤੇ ਜੋ ਹੈਡਫ਼ੋਨ ਸੀਗੇ ਉਹ ਬਿਲਕੁਲ ਬੇਕਾਰ ਨਾ ਉਸ ਦੀ ਆਵਾਜ਼ ਆ ਰਹੀ ਸੀ ਨਾ ਉਸ ਦੀ ਕੋਈ ਕੁਆਲਟੀ ਅੱਛੀ ਸੀਗੀ ਓਨਲਾਇਨ ਵਿੱਚ ਤਾਂ ਉਸ ਦੀ ਸਾਰਾ ਕੁਝ ਦੱਸਿਆ ਹੋਇਆ ਸੀ ਕੁਆਲਟੀ ਵਗੈਰਾ ਪਰ ਰੀਅਲ ਵਿੱਚ ਉਸ ਦੀ ਤਾਰ ਨਿਕਲੀ ਹੋਈ ਸੀ ਧੰਨਵਾਦ